ਅੱਜ ਕੱਲ੍ਹ ਸਾਰੇ ਲੋਕ ਆਪਣੇ ਵਿਹਲੇ ਟਾਈਮ ਦੇ ਵਿੱਚ ਬਹੁਤ ਅਲੱਗ ਅਲੱਗ ਤਰ੍ਹਾਂ ਦੀ ਡਰਾਇੰਗ ਬਣਾਉਂਦੇ ਆ ਜ਼ਿਆਦਾਤਰ ਲੋਕ ਘਰਾਂ ਦੀ ਸ਼ੋਪਿੰਗ ਜਿਹੜੀ ਹੁੰਦੀ ਆ ਉਹ ਬਜ਼ਾਰ 'ਤੇ ਜਾ ਕੇ ਕਰਦੇ ਆ ਕਿਉਂਕਿ ਘਰ ਬੈਠੇ ਫੋਨ 'ਤੇ ਉਹ ਰੰਗ ਰੰਗ ਨਹੀਂ ਦੇਖ ਸਕਦੇ ਅਤੇ ਇਹਦੇ ਕਰਕੇ ਅਤੇ ਕਈ ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਬਰੱਸ਼ ਯੂਜ ਕਰਨੇ ਪਸੰਦ ਨੇ ਅਤੇ ਉਹਦੇ ਕਰਕੇ ਉਹ ਜ਼ਿਆਦਾਤਰ ਬਜ਼ਾਰ 'ਤੇ ਵਿਜਿਟ ਕਰਦੇ ਆ ਅਤੇ ਉੱਥੇ ਸਮਾਨ ਵੀ ਸਸਤਾ ਮਿਲ ਜਾਂਦਾ ਏ